ਸਿੱਖਿਆ ਪ੍ਰਣਾਲੀ ਦਾ ਵਿਦਿਆਰਥੀਆਂ ਵਿੱਚ ਬਹੁਤ ਹੀ ਜ਼ਿਆਦਾ ਮਹੱਤਵ ਹੈ ਅਤੇ ਅਸੀਂ ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਨੂੰ ਬਹੁਤ ਹੀ ਉੱਚਾ ਪੱਧਰ 'ਤੇ ਲੈ ਕੇ ਜਾਨਾ ਹਾਂ ਜਾਣਾ ਚਾਹੁੰਦੇ ਹਾਂ ਤਾਂ ਕਿ ਜੋ ਸਾਡੇ ਪੰਜਾਬ ਦੀ ਸਿੱਖਿਆ ਹੈ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਬਹੁਤ ਜ਼ਿਆਦਾ ਪ੍ਰਚੱਲਤ ਹੋਵੇ ਅਤੇ ਇਸ ਲਈ ਇਹ ਬੱਚਿਆਂ ਨੂੰ ਇਸ ਤਰੀਕੇ ਨਾਲ ਤਿਆਰ ਕਰਨਾ ਚਾਹੁੰਦੇ ਹਾਂ ਕਿ ਉਹਨਾਂ ਨੂੰ ਅਸੀਂ ਸਾਰੇ ਜਿਹੜੇ ਵੋਕੇਸ਼ਨਲ ਕੋਰਸਿਸ ਕਮਰਸ ਅਕਾਊਂਟਸ ਨਾਲ ਰਿਲੇਟਡ ਮੈਥ ਸਾਇੰਸ ਐਸ ਐਸ ਟੀ ਸੋਸ਼ਲ ਸਾਇੰਸ ਸਾਰਾ ਕੁਛ ਉਹਨਾਂ ਨੂੰ ਇਸ ਤਰੀਕੇ ਨਾਲ ਸਿਖਾਉਣਾ ਚਾਹੁੰਦੇ ਹਨ ਵੀ ਉਹ ਜਿੱਥੇ ਮਰਜ਼ੀ ਚਲੇ ਜਾਣ ਉਹ ਸਾਰੇ ਚੀਜ਼ਾਂ ਦਾ ਉਹਨਾਂ ਨੂੰ ਗਿਆਨ ਮਿਲੇ ਅਤੇ ਗਿਆਨ ਹੋਵੇ ਤਾਂ ਕਿ ਉਹ ਦੂਸਰਿਆਂ ਨੂੰ ਵੀ ਗਿਆਨ ਦੇ ਸਕਣ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਕੂਲ ਵਿੱਚ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਨੂੰ ਇੱਕ ਜੋ ਵੀ ਚੀਜ਼ ਅਸੀਂ ਸਿਖਾਉਂਦੇ ਹਾਂ ਨਾਲ ਉਹਦਾ ਪ੍ਰੈਕਟੀਕਲ ਵੀ ਕਰਕੇ ਦਿਖਾਉਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਉਹਦੇ ਲਈ ਸਾਰੇ ਜਿਹੜੇ ਵੀ ਜਗ੍ਹਾ ਨੇ ਜਿੱਥੇ ਜੋ ਵੀ ਅਰਥ ਕਵੇਕ ਵਗੈਰਾ ਜੋ ਵੀ ਆਉਂਦਾ ਉਹ ਵੀ ਚੀਜ਼ ਉਹਨਾਂ ਨੂੰ ਦਿਖਾਈ ਜਾਵੇ ਪ੍ਰੈਕਟੀਕਲ ਦਿਖਾਈ ਜਾਵੇ ਥਰੈਟੀਕਲ ਦੀ ਜਗ੍ਹਾ ਪ੍ਰੈਕਟੀਕਲ ਦਿਖਾਈ ਜਾਵੇ ਤਾਂ ਕਿ ਬੱਚੇ ਜਿਹੜੇ ਉਸ ਚੀਜ਼ ਵਿੱਚ ਜ਼ਿਆਦਾ ਰੁਚੀ ਲੈ ਸਕਣ ਅਤੇ ਉਹਨੂੰ ਚੰਗੀ ਤਰ੍ਹਾਂ ਸਿੱਖ ਸਕਣ